ਮੈਂ ਅਕਸਰ ਛੋਟੇ ਛੋਟੇ ਕਸਬਿਆਂ ਵਿੱਚ ਆਪਣੇ ਕੰਮ ਕਰਕੇ ਜਾਂਦਾ ਰਹਿੰਦਾ ਹਾਂ ਮੇਰਾ ਸਕੂਟਰ ਮੋਟਰਸਾਈਕਲ ਸਪੇਅਰ ਪਾਰਟਸ ਦਾ ਕੰਮ ਹੈ ਮੈਨੂੰ ਹੁੰ ਕਸਬਿਆਂ ਵਿੱਚ ਸਕੂਟਰ ਹੁੰ ਮੁਰੰਮਤ ਕਰਨ ਵਾਲੇ ਅਤੇ ਦੁਕਾਨਦਾਰ ਦੁਕਾਨਾਂ ਵਾਲੇ ਮੇਰੇ ਗ੍ਰਾਹਕ ਹਨ ਮੈਂ ਉਹਨਾਂ ਨੂੰ ਸਕੂਰ ਸਕੂਟਰ ਅਤੇ ਮੋਟਰਸਾਈਕਲ ਪੁਰਜਿਆਂ ਦੀ ਸਪਲਾਈ ਕਰਦਾ ਹਾਂ ਇਸ ਤਰ੍ਹਾਂ ਮੇਰੀ ਆਮਦਨ ਦਾ ਸਾਧਨ ਵੀ ਬਣਿਆ ਹੈ ਅਤੇ ਉਹਨਾਂ ਦੀ ਆਮਦਨ ਦਾ ਸਾਧਨ ਵੀ ਵੀ ਮੈਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਸਪਲਾਈ ਦੇਣ ਵਿੱਚ ਹੀ ਰੁਚੀ ਰੱਖਦਾ ਹਾਂ ਕਿਉਂਕਿ ਇਹ ਦੁਕਾਨਦਾਰ ਵੱਡੀ ਮਾਰਕੀਟ ਵਿੱਚ ਪਹੁੰਚ ਨਹੀਂ ਸਕਦੇ ਹੇ ਸਕਦੇ ਤਾਂ ਮੈਂ ਉਹਨਾਂ ਨੂੰ ਨਵੀਆਂ ਆਉਣ ਵਾਲੀਆਂ ਗੱਡੀਆਂ ਦੇ ਪੁਰਜਿਆਂ ਬਾਰੇ ਜਾਣਕਾਰੀ ਦਿੰਦਾ ਹ ਹਾਂ ਮ ਅਤੇ ਮੈਨੂੰ ਪੁਰਜਿਆਂ ਦੀ ਪੂਰੀ ਸਪਲਾਈ ਦਿੰਦਾ ਹਾਂ ਮੇਰਾ ਮਕਸਦ ਉਹਨਾਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਵਪਾਰ ਦੇਣ ਦਾ ਹੈ ਹੁੰਦਾ ਹੈ ਕਿਉਂਕਿ ਮੈਂ ਵੀ ਇੱਕ ਛੋਟੀ ਜਿਹੀ ਦੁਕਾਨ ਤੋਂ ਹੀ ਸ਼ੁਰੂਆਤ ਕੀਤੀ ਸੀ ਇਸ ਤਰ੍ਹਾਂ ਮੈਂ ਇੱਕ ਕਈ ਛੋਟੇ ਛੋਟੇ ਕਸਬਿਆਂ ਵਿੱਚ ਘੁੰਮਦਾ ਹਾਂ ਜਿਵੇਂ ਟਾਂਡਾ ਮੁਕੇਰੀਆਂ ਭੋਗਪੁਰ ਦਸੂਆ ਹਜਾਰਾ ਪਿੰਡ ਮਲਸੀਆਂ ਫਲੋਰ ਗੁਰਾਇਆ ਫਗਵਾੜਾ ਹੰ ਜਲੰਧਰ ਨਾਲ ਕਈ ਹੋਰ ਲੱਗਦੇ ਪਿੰਡ ਅਤੇ ਕਸਬੇ ਹਨ